ਸਤਿ ਸ਼੍ਰੀ ਅਕਾਲ ਮੇਰਾ ਨਾਮ ਕਮਲਪ੍ਰੀਤ ਕੌਰ ਮੈਂ ਤੁਹਾਡੀ ਏਜੰਸੀ ਤੋਂ ਕੈਬ ਬੁੱਕ ਕੀਤੀ ਸੀ ਤੁਹਾਡੇ ਡਰਾਈਵਰ ਦਾ ਨਾਮ ਦਲਜੀਤ ਸਿੰਘ ਜੋ ਕਿ ਬਹੁਤ ਲੇਟ ਪਹੁੰਚਿਆ ਮੈਂ ਟਾਈਮ ਦਿੱਤਾ ਸੀ ਸਾਢੇ ਚਾਰ ਦਾ ਅਤੇ ਉਹ ਪਹੁੰਚਿਆ ਪੰਜ ਵਜੇ ਪਰ ਉਹਨੇ ਫਿਰ ਵੀ ਕਿਹਾ ਕਿ ਚਲੋ ਕੋਈ ਨਹੀਂ ਮੈਂ ਤੁਹਾਨੂੰ ਟਾਈਮ ਨਾਲ ਪਹੁੰਚਾ ਦੇਵਾਂਗਾ ਅਤੇ ਮੈਂ ਵਿਸ਼ਵਾਸ ਕਰਕੇ ਉਹਦੇ ਨਾਲ ਗਈ ਹਾਂ ਕਿ ਚਲੋ ਪਹੁੰਚਾ ਦੇਵੇਗਾ ਟਾਈਮ ਨਾਲ ਪਰ ਜਦੋਂ ਅਸੀਂ ਰੇਲਵੇ ਸਟੇਸ਼ਨ 'ਤੇ ਪਹੁੰਚੇ ਤਾਂ ਟ੍ਰੇਨ ਮੇਰੀ ਜਾ ਚੁੱਕੀ ਸੀ ਟ੍ਰੇਨ ਦਾ ਟਾਈਮ ਸੀਗਾ ਅੱਠ ਵਜੇ ਦਾ ਅਤੇ ਉਹਨਾਂ ਨੇ ਮੈਨੂੰ ਸਵਾ ਅੱਠ ਪਹੁੰਚਾਇਆ ਅਤੇ ਹੁਣ ਮੈਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਇੱਥੇ ਹੁਣ ਮੈਂ ਟ੍ਰੇਨ ਤਾਂ ਬਹੁਤ ਇਸ ਤੋਂ ਬਾਅਦ ਬਹੁਤ ਲੇਟ ਟ੍ਰੇਨ ਹੈ ਰਾਤ ਵਾਲੀ ਹੈ ਅਤੇ ਮੈਨੂੰ ਹੁਣ ਬੱਸ ਵਿੱਚ ਸਰਵਾਈਵ ਕਰਨਾ ਪਊਗਾ ਅਤੇ ਜੋ ਕਿ ਮੇਰੇ ਲਈ ਬਹੁਤ ਮੁਸ਼ਕਲ ਹੈ ਮੈਂ ਮੇਰੀ ਹੈਲਥ ਵੀ ਇੰਨੀ ਸਹੀ ਨਹੀਂ ਹੈ ਕਿ ਮੈਂ ਬੱਸ ਵਿੱਚ ਜਾ ਸਕਾਂ ਅਤੇ ਮੇਰਾ ਜਾਣਾ ਵੀ ਬਹੁਤ ਜ਼ਰੂਰੀ ਹੈ ਮੈਂ ਤੁਹਾਡੀ ਕੈਬ ਬੁੱਕ ਕੀਤੀ ਸੀ ਜੋ ਉਸ ਤੋਂ ਮੈਂ ਬਿਲਕੁਲ ਵੀ ਖੁਸ਼ ਨਹੀਂ ਹਾਂ ਅਤੇ ਜਾਂ ਮੈਨੂੰ ਮੇਰੇ ਪੈਸੇ ਵਾਪਸ ਕੀਤੇ ਜਾਣ